ਪੰਜਾਬ 'ਚ ਲੋਕ ਵਿਆਹ ਦੇ ਟਾਈਮ 'ਤੇ ਆਪਣੀ ਜਿਹੜੀ ਲਾੜੀ ਹੈ ਉਹਨਾਂ ਨੂੰ ਬਹੁਤ ਤਰੀਕੇ ਦੇ ਤੋਹਫ਼ੇ ਦਿੰਦੇ ਹਨ ਜਿਵੇਂ ਕਿ ਵਾਸ਼ਿੰਗ ਮਸ਼ੀਨ ਹੋ ਗਈ ਅਲਮਾਰੀ ਹੋ ਗਈ ਬੈੱਡ ਹੋ ਗਏ ਕੂਲਰ ਹੋ ਗਏ ਤਾਂ ਕਿ ਜਿਹੜੀ ਉਹਨਾਂ ਦੀ ਕੁੜੀ ਹੈ ਉਹ ਚੰਗੇ ਤਰੀਕੇ ਨਾਲ਼ ਰਹਿ ਸਕੇ ਕੁਝ ਖੇਤਰ 'ਚ ਪੰਜਾਬ 'ਚ ਹੋਰ ਵੀ ਵੱਖ ਵੱਖ ਤਰੀਕੇ ਦੇ ਜਿਹੜੇ ਤੋਹਫ਼ੇ ਦਿੱਤੇ ਜਾਂਦੇ ਹਨ ਜਿਵੇਂ ਕਿ ਕੁਛ ਲੋਕ ਤਾਂ ਕਰਜ਼ਾ ਲੈ ਕੇ ਆਪਣੇ ਜਿਹੜੀ ਕੁੜੀ ਹੈ ਉਹਨਾਂ ਨੂੰ ਉਹ ਗੱਡੀਆਂ ਜਾਂ ਬੜੀ ਬੜੀ ਮਹਿੰਗੀਆਂ ਜਿਹੜੇ ਮੋਟਰਸਾਈਕਲ ਹਨ ਜਾਂ ਘਰ ਉਹ ਵੀ ਤੋਹਫ਼ੇ ਦੇ ਤਰੀਕੇ 'ਤੇ ਦਿੱਤੇ ਜਾਂਦੇ ਹਨ ਪਰ ਇਸ 'ਚ ਜਿਹੜੀ ਇੱਕ ਬਹੁਤ ਬੁਰੀ ਗੱਲ ਹੈ ਕਿ ਉਹ ਬਹੁਤ ਹੀ ਜ਼ਿਆਦਾ ਕਰਜ਼ਾ ਲੈ ਲੈਂਦੇ ਹਨ ਜਿਹਦੇ ਕਰਕੇ ਉਹ ਖੁਦਕੁਸ਼ੀ ਦਾ ਕਾਰਨ ਵੀ ਬਣਦੇ ਹਨ